ਪੁਰਾਣੇ ਟਾਇਮ ਦੇ ਸਿੱਕੇ ਦਾ ਮੁੱਲ ਅੱਜ ਦੇ ਟਾਇਮ ਦੇ ਸਿੱਕਿਆ 'ਚ ਬਹੁਤ ਹੈ ਕਿਉਂਕਿ ਇਹ ਸਿੱਕੇ ਪੁਰਾਣੇ ਟਾਇਮ ਦੇ ਸਿੱਕੇ ਸਾਨੂੰ ਅੱਜ ਦੇ ਟਾਇਮ 'ਚ ਪੁਰਾਣਾ ਟਾਇਮ ਯਾਦ ਕਰਾਉਂਦੇ ਨੇ ਇਨ੍ਹਾਂ ਦਾ ਮੁੱਲ ਉਸ ਟਾਇਮ ਪੁਰਾਣੇ ਟਾਇਮ ਵਿੱਚ ਬਹੁਤ ਸੀ ਅਤੇ ਅੱਜ ਦੇ ਟਾਇਮ 'ਚ ਵੀ ਬਹੁਤ ਹੈ ਕਿਉਂਕਿ ਇਸ ਨਾਲ ਸਾਨੂੰ ਪੁਰਾਣਾ ਇਤਿਹਾਸ ਯਾਦ ਆਉਂਦਾ ਹੈ ਅਤੇ ਹੋਰ ਕਈ ਗੱਲਾਂ ਦਾ ਵੀ ਵਰਨਣ ਕੀਤਾ ਜਾਂਦਾ ਹੈ ਕਿਉਂਕਿ ਇਹ ਪੁਰਾਣੇ ਟਾਇਮ ਦੇ ਹਨ ਜੋ ਅੱਜ ਦੇ ਟਾਇਮ ਦੇ ਹੈ ਉਨ੍ਹਾਂ ਦਾ ਅੱਜ ਦੇ ਟਾਇਮ 'ਚ ਵੀ ਬਹੁਤ ਮੁੱਲ ਹੈ